ਮੈਂ ਕੈਬ ਬੁੱਕ ਕਰਵਾਈ ਸੀ ਅਤੇ ਕੈਬ ਵਾਲਾ ਬਹੁਤ ਹੀ ਜ਼ਿਆਦਾ ਪੈਸੇ ਮੰਗ ਰਿਹਾ ਸੀ ਅਤੇ ਮੈਂ ਡੇਲੀ ਦਾ ਆਉਣ ਜਾਣ ਵਾਲਾ ਹਾਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੇਰੇ ਕੈਬ ਦੇ ਪੈਸੇ ਘੱਟ ਤੋਂ ਘੱਟ ਲੈਣ ਮੈਂ ਕੈਬ ਦੇ ਇੰਨੇ ਜ਼ਿਆਦਾ ਪੈਸੇ ਨਹੀਂ ਦੇ ਸਕਦਾ ਮੈਂ ਕੈਬ ਦੇ ਘੱਟ ਤੋਂ ਘੱਟ ਪੈਸੇ ਹੀ ਦੇ ਸਕਦਾ ਹਾਂ ਕੈਬ ਵਾਲੇ ਨੂੰ ਵੱਧ ਪੈਸੇ ਨਹੀਂ ਦੇ ਸਕਦਾ ਇਸ ਕਰਕੇ ਬੇਨਤੀ ਕੀਤੀ ਜਾਂਦੀ ਹੈ ਕਿ ਮੈਥੋਂ ਪੈਸੇ ਘੱਟ ਤੋਂ ਘੱਟ ਲੈਣ ਕਿਰਪਾ ਕਰਕੇ ਮੇਰਾ ਜਾਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਮੈਥੋਂ ਮੇਰੇ ਤੋਂ ਪੰਜਾਹ ਪਰਸੈਂਟ ਕੈਤ ਦੀ ਛੂਟ ਦਿੱਤੀ ਜਾਵੇ ਮੈਂ ਹਰ ਵਾਰੀ ਇਹ ਕੈਬ ਬੁੱਕ ਕਰਵਾਵਾਂਗਾ